ਹਾਂ ਮੈਂ ਬਹੁਤ ਸਾਰੀਆਂ ਕਲਾ ਪ੍ਰਦਰਸ਼ਨੀ ਜੇਕਸਪੋਸ ਦਾ ਦੌਰਾ ਕੀਤਾ ਹੈ ਜਿਨ੍ਹਾਂ ਵਿੱਚੋਂ ਸਾਇੰਸ ਦਾ ਦੌਰਾ ਬਹੁਤ ਹੀ ਸਾਡੇ ਸਕੂਲ ਵਿੱਚ ਲੱਗਿਆ ਸੀ ਅਤੇ ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਸਾਇੰਸ ਨਾਲ ਰਿਲੇਟਡ ਕਲਾ ਪ੍ਰਦਰਸ਼ਨੀਆਂ ਦਾ ਦੀ ਕਿਰਿਆ ਕੀਤੀ ਉਸ ਵਿੱਚ ਬਹੁਤ ਸਾਰੀ ਜਿਸ ਵਿੱਚ ਮੈਨੂੰ ਬਹੁਤ ਸਾਰਾ ਗਿਆਨ ਪ੍ਰਾਪਤ ਹੋਇਆ ਇਸ ਤੋਂ ਇਲਾਵਾ ਬਾ ਬਾਬਾ ਸਾਨੂੰ ਬਾਬਾ ਫਰੀਦ ਵਿੱਚ ਦੇ ਮੇਲੇ ਮੌਕੇ ਵੀ ਬਹੁਤ ਸਾਰੀ ਕਲਾ ਪ੍ਰਦਰਸ਼ਨੀ ਸੀ ਜਿਸ ਵਿੱਚ ਬਹੁਤ ਸਾਰੀ ਫੁਲਕਾਰੀ ਕੱਪੜੇ ਅਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਜੋ ਸਾਡੇ ਸੱਭਿਆਚਾਰ ਨਾਲ ਰਿਲੇਟਡ ਸੀ ਉਹ ਮਿਲੀਆਂ ਇਸ ਤੋਂ ਇਲਾਵਾ ਸਾਡੇ ਅਧਿਆਪਕ ਸਾਹਿਬਾਨਾਂ ਨੇ ਸਾਨੂੰ ਹੋਰ ਸਾਇੰਸ ਨਾਲ ਰਿਲੇਟਡ ਫੇਅਰ ਸਾਨੂੰ ਨਾਲ ਦੇ ਸਕੂਲਾਂ ਵਿੱਚ ਵੀ ਲੈ ਕੇ ਗਏ ਉੱਥੋਂ ਸਾਨੂੰ ਇਸ ਨਾਲ ਰਿਲੇਟਡ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈ ਸਾਇੰਸ ਨਾਲ ਰਿਲੇਟਡ ਜੀ ਮੇਲੇ ਵਿੱਚ ਸਾਨੂੰ ਬਹੁਤ ਸਾਰਾ ਗਿਆਨ ਪ੍ਰਾਪਤ ਹੋਇਆ ਅਤੇ ਇਸ ਤੋਂ ਇਲਾਵਾ ਬਾਬਾ ਫਰੀਦ ਜੀ ਦੇ ਮੇਲੇ ਵਿੱਚ ਵੀ ਪ੍ਰਦਰਸ਼ਨੀ ਲੱਗੀ ਜਿਸ ਵਿੱਚ ਸਾਇੰਸ ਫੇਅਰ ਨਾਲ ਰਿਲੇਟਡ ਬਹੁਤ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਸਨ ਜਿਹਨਾਂ ਤੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈ ਅਤੇ ਇਸ ਤੋਂ ਇਲਾਵਾ ਦੂਸਰੀ ਸਾਈਡ ਬੁਕਸ ਦੇ ਨਾਲ ਰਿਲੇਟਡ ਵੀ ਐਕਜੀਬਿਸ਼ਨ ਲੱਗੀ ਹੋਈ ਸੀ ਵੱਖ ਵੱਖ ਕਿਤਾਬਾਂ ਜੋ ਕਿ ਸਾਡੀ ਪੜ੍ਹਾਈ ਨਾਲ ਸੰਬੰਧਿਤ ਸਨ ਉਹਨਾਂ ਤੋਂ ਵੀ ਸਾਨੂੰ ਬਹੁਤ ਸਾਰਾ ਗਿਆਨ ਪ੍ਰਾਪਤ ਹੋਇਆ ਇਸ ਤਰ੍ਹਾਂ ਅਸੀਂ ਵੱਖ ਵੱਖ ਐਕਸਪੋਜ ਦੇ ਦੌਰ ਦੌਰਾ ਕੀਤਾ ਹੈ ਇਸ ਤੋਂ ਇਲਾਵਾ ਸਾਡੇ ਕੋਲਜ ਵਿੱਚ ਵੀ ਇੱਕ ਵਾਰ ਸਾਇੰਸ ਫੇਅਰ ਲੱਗਿਆ ਸੀ ਉੱਥੇ ਬਹੁਤ ਸਾਰੇ ਬੱਚਿਆਂ ਨੇ ਆਪਣੀ ਸਾਇੰਸ ਨਾਲ ਰਿਲੇਟਡ ਅਲੱਗ ਅਲੱਗ ਪ੍ਰੋਜੈਕਟ ਤਿਆਰ ਕੀਤੇ ਸਨ ਜਿਨ੍ਹਾਂ ਵਿੱਚੋਂ ਇੱਕ ਸਾਇੰਸ ਨਾਲ ਰਿਲੇਟਡ ਟੋਪਿਕ ਕ ਦਾ ਅਰੇਂਜਮੈਂਟ ਕੀਤਾ ਗਿਆ ਬੱਚਿਆਂ ਵੱਲੋਂ ਅਤੇ ਉਹਨਾਂ ਨੇ ਇਸ ਪੂਰੀ ਐਗਜੀਬਿਸ਼ਨ ਨਾਲ ਐਕਸਪਲੇਨ ਕਰਕੇ ਸਾਨੂੰ ਪੂਰਾ ਉਸ ਬਾਰੇ ਦੱਸਿਆ ਫਿਰ ਸਾਨੂੰ ਕਈ ਬੱਚਿਆਂ ਨੇ ਸਾਇੰਸ ਫੇਅਰ 'ਚ ਕੈਮੀਕਲ ਨਾਲ ਰਿਲੇਟਡ ਬਹੁਤ ਵਧੀਆ ਚੀਜ਼ ਦੱਸੀ ਇਸ ਲਈ ਸਾਨ ਬਹੁਤ ਸਾਰੀ ਐਗਜੀਬਿਸ਼ਨ ਦਾ ਅਨੁਭਵ ਸਾਂਝਾ ਕੀਤਾ ਅਸੀਂ ਸਾਰਿਆਂ ਨੇ ਜਿਸ ਨਾਲ ਸਾਨੂੰ ਬਹੁਤ ਸਾਰੇ ਗਿਆਨ ਦੀ ਪ੍ਰਾਪਤੀ ਕੀਤੀ ਇਸ ਤੋਂ ਇਲਾਵਾ ਅਸੀਂ ਹੁਣ ਫੇਰ ਕਿਸੇ ਐਕਸਪੋ 'ਤੇ ਜਾਣਾ ਚਾਹਾਂਗੇ ਜੇ ਸਾਨੂੰ ਕੋਈ ਸਾਇੰਸ ਨਾਲ ਰਿਲੇਟਡ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਅਸੀਂ ਇਹੋ ਜਿਹੀ ਸਾਇੰਸ ਨਾਲ ਰਿਲੇਟਡ ਮੇਲੇ 'ਤੇ ਜਾਣਾ ਚਾਹਾਂਗੇ